ਹਾਂਜੀ ਅੱਜ ਕੱਲ੍ਹ ਦੇ ਯੁੱਗ ਵਿੱਚ ਇੰਟਰਨੈੱਟ ਸੇਵਾਵਾਂ ਬਹੁਤ ਤੇਜੀ ਨਾਲ ਚੱਲ ਰਹੀਆਂ ਹਨ ਜਿਸ ਤੋਂ ਅਸੀਂ ਵੱਖ ਵੱਖ ਲਾਹੇ ਪ੍ਰਾਪਤ ਕਰ ਸਕਦੇ ਹਾਂ ਜਿਵੇਂ ਕੀ ਅਸੀਂ ਆਪਣਾ ਮਨਪਸੰਦ ਭੋਜਨ ਆਰਡਰ ਕੀਤਾ ਹੋਵੇ ਕਿਸੇ ਵੈਬ ਵੈੱਬਸਈਟਸ 'ਤੇ ਅਸੀਂ ਸਵੈ ਭੁਗਤਾਨ ਨੂੰ ਤੋਂ ਉਸ ਨੂੰ ਔਡਰ ਵੀ ਕਰ ਸਕਦੇ ਹਾਂ ਅਤੇ ਉਸ ਤੋਂ ਉਸ ਨੂੰ ਰੱਦ ਵੀ ਕਰ ਸਕਦੇ ਹਾਂ ਉਨ੍ਹਾਂ ਦੀਆਂ ਸੈਟਿੰਗਾਂ ਵਿੱਚ ਜਾ ਕੇ ਅਸੀਂ ਉਹਨਾਂ ਨੂੰ ਸਵੈ ਭੁਗਤਾਨ ਵਾਲੀ ਸੈਟਿੰਗ ਦੇ ਵਿੱਚ ਜਾ ਕੇ ਉਸ ਨੂੰ ਰੱਦ ਵੀ ਕਰ ਸਕਦੇ ਹਾਂ ਜਿਵੇਂ ਕਿ ਇਸ ਦ੍ਰਿਸ਼ ਵਿੱਚ ਦੱਸ ਦੱਸਿਆ ਗਿਆ ਹੈ ਕਿ ਪਹਿਲਾ ਕਿਸੇ ਖ਼ਾਸ ਵੈੱਬਸਾਈਟ ਅਤੇ ਐਪ 'ਤੇ ਆਪਣਾ ਭੋਜਨ ਆਰਡਰ ਲਈ ਸਵੈ ਭੁਗਤਾਨ ਸੈੱਟਅੱਪ ਕੀਤਾ ਪਰ ਤੁਸੀਂ ਕਿਸੇ ਕਾਰਨ ਇਸ ਵਿਵਸਥਾ ਨੂੰ ਰੱਦ ਕਰਨਾ ਚਾਹੁੰਦੇ ਹਾਂ ਤਾਂ ਇਹ ਬਹੁਤ ਹੀ ਸਹੀ ਤਰੀਕਾ ਹੈ ਕਿ ਤੁਸੀਂ ਉਨ੍ਹਾਂ ਦੀ ਸੈਟਿੰਗ ਵਿੱਚ ਜਾ ਕੇ ਉਸ ਵਿਕਲਪ ਨੂੰ ਰੱਦ ਕਰ ਸਕਦੇ ਹੋ ਜਿਸ ਨਾਲ ਉਹ ਸਮੇਂ 'ਤੇ ਰੱਦ ਹੋ ਸਕਦਾ ਹੈ